ਸਤਿ ਸ਼੍ਰੀ ਅਕਾਲ ਜੀ ਹਾਂ ਕਿਤਾਬਾਂ ਬਚਪਨ ਤੋਂ ਹੀ ਮੇਰੀ ਪੱਕੀ ਸਹੇਲੀਆਂ ਰਹੀਆਂ ਹਨ ਤੇ ਜਦੋਂ ਵੀ ਆਪਣੇ ਆਪ ਨਾਲ ਸਮਾਂ ਬਤੀਤ ਕਰਨਾ ਚਾਹੁੰਦੀ ਆਂ ਤਾਂ ਹਮੇਸ਼ਾ ਕਿਤਾਬਾਂ ਪੜ੍ਹਦੀ ਆ ਅਤੇ ਥੋੜੀ ਬਹੁਤ ਲਿਖਣ ਦੀ ਵੀ ਰੁਚੀ ਰੱਖਦੀ ਐ ਮਸ਼ਹੂਰ ਲੇਖਕਾ ਚਿੱਤਰਾ ਬੈਨਰਜੀ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਜਿਵੇਂ ਪੈਲਸ ਔਫ ਇਲਊਜ਼ਨਸ ਮਿਸਟਰਸ ਔਫ ਸਪਾਈਸਿਸ ਅਤੇ ਓਲੀਐਂਡਰ ਗੋਲ ਹਮੇਸ਼ਾ ਹੀ ਮੇਰੇ ਮਨ ਨੂੰ ਬੜਾ ਸਕੂਨ ਦਿੰਦੀਆਂ ਹਨ ਇਸ ਤੋਂ ਇਲਾਵਾ ਕਈ ਹੋਰ ਜਾਨੀ ਮਾਨੀ ਲੇਖਕਾਵਾਂ ਜਿਵੇਂ ਕੋਲਨ ਹਵਰ ਕ੍ਰਿਸਟੀ ਨਾਲ ਲੋਰਨ ਵਰਗੀਆਂ ਲਿਖਕਾਵਾਂ ਮੇਰੇ ਮਨ ਨੂੰ ਬੜਾ ਭਾਉਂਦੀਆਂ ਹਨ ਅਤੇ ਇਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਮੇਰੇ ਲਈ ਪ੍ਰੇਣਾ ਦਾ ਸਰੋਤ ਬਣਦੀਆਂ ਹਨ ਜਿੱਥੇ ਤੱਕ ਗੱਲ ਹ ਮਹਾਭਾਰਤ ਅਤੇ ਰਮਾਇਣ ਦੀ ਤੇ ਇਹਨਾਂ ਵਧੀਆ ਮਹਾਕਾਫ ਭਾਰਤੀ ਲੇਖਕਾਂ ਦੇ ਵਿਸ਼ਿਆਂ ਨੂੰ ਕਿਤੇ ਵੱਧ ਪ੍ਰਭਾਵਿਤ ਕਰਦੇ ਹਨ ਅਤੇ ਮੈਂ ਆਪ ਹੀ ਇਹਨਾਂ ਮਹਾਂਕਾਵਿਆਂ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਆ ਹਾਲਾਂਕਿ ਜਦੋਂ ਮੈਂ ਲਿਖਦੀ ਆਂ ਤੇ ਜਿਆਦਾਤਰ ਰੋਜ਼ਮਰਾ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਕੇ ਤੇ ਉਹਨਾਂ ਤੋਂ ਪ੍ਰਭਾਵਿਤ ਹੋਈਆਂ ਕਹਾਣੀਆਂ ਹੀ ਆਪਣੇ ਅੱਖਰਾਂ ਵਿੱਚ ਲਿਖਣਾ ਪਸੰਦ ਕਰਦੀ ਆਂ